ਹਾਂਜੀ ਸਾਡੀ ਰੋਜ਼ੀ ਰੋਟੀ ਬਿਜਲੀ 'ਤੇ ਹੀ ਨਿਰਭਰ ਕਰਦੀ ਹੈ ਜੇਕਰ ਲਾਈਟ ਚਲੀ ਜਾਵੇ ਤਾਂ ਘਰ ਵਿੱਚ ਬਹੁਤ ਸਾਰਾ ਹਨੇਰਾ ਹੋ ਜਾਂਦਾ ਹੈ ਅਤੇ ਅਸੀਂ ਰੋਟੀ ਬਣਾ ਹੀ ਨਹੀਂ ਸਕਦੇ ਕਿਉਂਕਿ ਘਰ ਵਿੱਚ ਬਹੁਤ ਹਨੇਰਾ ਹੋ ਜਾਂਦਾ ਹੈ ਕਈ ਵਾਰ ਤਾਂ ਕਈ ਕਈ ਘੰਟਿਆਂ ਤੱਕ ਹੀ ਨਹੀਂ ਲਾਈਟ ਆਉਂਦੀ ਕਈ ਵਾਰ ਜੇ ਆਉਣੀ ਹੋਵੇ ਤਾਂ ਦੋ ਸਕਿੰਟ 'ਚ ਵੀ ਆ ਜੇ ਕਈ ਕਈ ਵਾਰ ਤਾਂ ਸਾਰਾ ਸਾਰਾ ਦਿਨ ਹੀ ਨਹੀਂ ਲਾਈਟ ਆਉਂਦੀ ਇਸ ਕਰਕੇ ਸਾਡੀ ਰੋਜ਼ੀ ਰੋਟੀ ਬਣਨ ਵਿੱਚ ਬਹੁਤ ਦਿੱਕਤ ਆਉਂਦੀ ਹੈ ਸਾਨੂੰ ਰੋ ਰੋਜ਼ਾਨਾ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਆਉਂਦੀਆਂ ਹਨ ਬਿਜਲੀ ਕਰਕੇ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਿਜਲੀ ਦੇ ਕੱਟ ਬਹੁਤ ਸਾਰੇ ਲੱਗਦੇ ਹਨ ਕਈ ਕਈ ਘੰਟਿਆਂ ਦੇ ਵੀ ਲੱਗਦੇ ਹਨ ਅਤੇ ਕਈ ਕਈ ਕਈ ਵਾਰ ਤਾਂ ਉਹ ਕ ਸਾਰਾ ਦਿਨ ਹੀ ਲੱਗ ਜਾਂਦਾ ਹੈ ਲਾਈਟ ਹੀ ਨਹੀਂ ਆਉਂਦੀ ਇਸ ਕਰਕੇ ਸਾਡੀ ਜਿਹੜੀ ਕਿ ਰੋਜ਼ਾਨਾ ਰੋਟੀ ਹੈ ਉਹ ਬਣਨ ਵਿੱਚ ਬਹੁਤ ਟਾਈਮ ਲੱਗਦਾ ਹੈ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਅਸੀਂ ਆਪਣੀ ਲਾਈਫ ਵਿੱਚ ਬਿਜਲੀ ਦਾ ਬਹੁਤ ਪ੍ਰਯੋਗ ਕਰਦੇ ਹਾਂ